ਸੈਲਫ ਹੈਲਪ ਗਰੁੱਪ ਕਿਸੇ ਵੀ ਕੰਮ ਨੂੰ ਸ਼ੁਰੂਆਤ ਕਰਨ ਦਾ ਇੱਕ ਬਹੁਤ ਵਧੀਆ ਸਾਧਨ ਹੈ ਇਸ ਦੇ ਵਿੱਚ ਕਿਸੇ ਵਰਗ ਜਾਂ ਕਮੇਟੀ ਦੇ ਲੋਕ ਆਪਸ ਵਿੱਚ ਜੁੜ ਕੇ ਕੋਈ ਨਾ ਕੋਈ ਉਪਰਾਲਾ ਸ਼ੁਰੂ ਕਰਦੇ ਹਨ ਇਹ ਔਰਤਾਂ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ ਜਿਵੇਂ ਕਿ ਕਿਸੇ ਵੀ ਏਰੀਆ ਦੀਆਂ ਔਰਤਾਂ ਆਪਣੇ ਲੋਕਲ ਆਰਟ ਨੂੰ ਪੂਰੇ ਦੁ ਵਿਸ਼ਵ ਤੱਕ ਲੈ ਕੇ ਜਾਣ ਦੇ ਲਈ ਇਕੱਠੇ ਹੋ ਕੇ ਕੰਮ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਪੂਰੇ ਵਿਸ਼ਵ ਦੇ ਵਿੱਚ ਵੇਚ ਸਕਦੀਆਂ ਹਨ ਸਿਲਾਈ ਕਢਾਈ ਆਦਿ ਚੀਜ਼ਾਂ ਹਰ ਜਗ੍ਹਾ 'ਤੇ ਹੀ ਚੱਲਦੀਆਂ ਹਨ ਔਰਤਾਂ ਸ ਆਪਣੇ ਗਰੁੱਪ ਬਣਾ ਕੇ ਅਤੇ ਉੱਥੇ ਅਲੱਗ ਅਲ ਵੱਖ ਵੱਖ ਚੀਜ਼ਾਂ ਬਣਾ ਕੇ ਉਸ ਨੂੰ ਪੂਰੀ ਦੁਨੀਆਂ ਦੇ ਵਿੱਚ ਵੇਚ ਸਕਦੀਆਂ ਹਨ